ਮੈਂ ਤੁਹਾਡੀ ਕੰਪਨੀ ਤੋਂ ਔਨਲਾਈਨ ਇੱਕ ਓਡਰ ਕੀਤਾ ਸੀ ਅਤੇ ਉਹ ਓਡਰ ਮੇਰੇ ਕੋਲ ਬਹੁਤ ਹੀ ਜਲਦੀ ਪਹੁੰਚ ਗਿਆ ਜਦੋਂ ਮੈਂ ਪਾਰਸਲ ਖੋਲ੍ਹ ਕੇ ਦੇਖਿਆ ਤਾਂ ਮੈਨੂੰ ਦੇਖ ਕੇ ਬਹੁਤ ਹੀ ਖੁਸ਼ੀ ਹੋਈ ਉਸ ਵਿੱਚ ਮੈਂ ਕੁੜਤਾ ਮੰਗਾਏ ਹੋਏ ਸੀ ਅਤੇ ਕੁੜਤੇ ਪਾ ਕੇ ਦੇਖਿਆ ਤਾਂ ਕੁੜਤੇ ਦੀ ਫੀਟਿੰਗ ਬਹੁਤ ਹੀ ਸੋਹਣੀ ਸੀ ਅਤੇ ਕੁੜਤੇ ਦਾ ਰੰਗ ਵੀ ਬਹੁਤ ਸੋਹਣਾ ਸੀ ਉਸ ਨੂੰ ਦੇਖ ਕੇ ਮੈਨੂੰ ਹੋਰ ਵੀ ਜ਼ਿਆਦਾ ਖੁਸ਼ੀ ਹੋਈ ਅਤੇ ਦੋ ਤਿੰਨ ਵਾਰ ਮੈਂ ਧੋ ਕੇ ਵੀ ਦੇਖਿਆ ਕੁੜਤਾ ਤਾਂ ਉਸ ਤੋਂ ਬਾਅਦ ਵੀ ਉਸ ਦਾ ਕਲਰ ਚੇਂਜ ਨਹੀਂ ਹੋਇਆ ਅਤੇ ਅਤੇ ਇਸ ਕੁੜਤੇ ਦੀ ਮੇਰੇ ਘਰਦੇ ਮੇਰੇ ਮਿੱਤਰ ਸਹੇਲੀਆਂ ਨੇ ਬਹੁਤ ਹੀ ਜ਼ਿਆਦਾ ਤਾਰੀਫ ਕੀਤੀ ਅਤੇ ਉਹ ਵੀ ਕਹਿਣ ਲੱਗੇ ਕਿ ਅਸੀਂ ਵੀ ਇਹ ਕੁੜਤੀ ਮੰਗਵਾਉਣੀ ਹੈ